ਪੰਜਾਬ ਵਿੱਚ ਮੰਨੋਰੰਜਨ ਉਦਯੋਗ ਦੀ ਗੱਲ ਕਰੀਏ ਤਾਂ ਕਈ ਲੋਕ ਲੋਕਾਂ ਦਾ ਮੰਨੋਰੰਜਨ ਕਰਨ ਲਈ ਵੀਡੀਓਜ਼ ਬਣਾਉਂਦੇ ਹਨ ਅਤੇ ਜਿਸ ਨਾਲ ਓਹਨਾਂ ਨੂੰ ਖੁਸ਼ੀ ਵੀ ਹੁੰਦੀ ਹੈ ਇਸ ਨਾਲ ਲੋ ਓਹਨਾਂ ਦੀਆਂ ਵੀਡਿਓਜ਼ ਵੀ ਦੇਖ ਕੇ ਲੋਕ ਵੀ ਬਹੁਤ ਖੁਸ਼ ਹੁੰਦੇ ਹਨ ਉਹਨਾਂ ਨੂੰ ਇਹ ਵੀਡੀਓਜ਼ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਪਰ ਕਈ ਵਾਰ ਓਹ ਕੁਛ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ ਜਿਸ ਕਾਰਨ ਅ ਓਹ ਵਾਤਾਵਰਨ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਜਿਵੇਂ ਕਿ ਕਈ ਲੋਕ ਹਥਿਆਰਾਂ ਦਾ ਇਸਤੇਮਾਲ ਕਰਦੇ ਹਨ ਆਪਣੀ ਵੀਡੀਓਜ਼ ਵਿੱਚ ਅੱਜ ਕੱਲ੍ਹ ਦੇ ਜਿਹੜੇ ਯੰਗ ਬੱਚੇ ਨੇ ਓਹ ਉਹਨਾਂ ਵੀਡੀਓ ਨੂੰ ਦੇਖਦੇ ਨੇਗੇ ਅਤੇ ਓਹੀ ਚੀਜ਼ਾਂ ਕਰਦੇ ਨੇ ਕਈ ਲੋਕ ਗੋਲੀਆਂ ਚਲਾਉਂਦੇ ਨੇ ਵੀਡੀਓਜ਼ 'ਚ ਜਿਸ ਨਾਲ ਵਾਤਾਵਰਨ ਬਹੁਤ ਪ੍ਰਭਾਵਿਤ ਹੁੰਦਾ ਪੋਲਿਊਸ਼ਨ ਹੁੰਦਾ ਇੱਕ ਜਿਵੇਂ ਕਿ ਹਾਲ ਹੀ ਵਿੱਚ ਇੱਕ ਖਬਰ ਆਈ ਕਿ ਇੱਕ ਲੜਕੀ ਨੇ ਵੀਡਿਓ ਬਣਾਉਣ ਲਈ ਆਪਣੇ ਅ ਪਿੱਛੇ ਦੇ ਜੰਗਲ ਸਿਰ ਦੇ ਜਿੱਥੇ ਓਹ ਖੜ੍ਹੀ ਹੋਈ ਸੀ ਉਸ ਨੇ ਉੱਥੇ ਅੱਗ ਲਗਾ ਦਿੱਤੀ ਪਰ ਉਸਨੇ ਇਹ ਬਿਲਕੁਲ ਵੀ ਨਹੀਂ ਸੋਚਿਆ ਕਿ ਉਸ ਨਾਲ ਜਾਨਵਰਾਂ ਨੂੰ ਵੀ ਤਕਲੀਫ ਹੋਏਗੀ ਜਾਂ ਪਲਿਊਸ਼ਨ ਬਹੁਤ ਵਧੇਗਾ ਅਤੇ ਇਸ ਕਾਰਨ ਓਹਨਾਂ ਨੂੰ ਇਵੇਂ ਦੀਆਂ ਗਲਤੀਆਂ ਵੀਡੀਓਜ਼ ਬਣਾਉਣ ਲਈ ਓਹ ਬਹੁਤ ਲਾਇਕ ਲੈਣ ਲਈ ਇਹੋ ਜਿਹੀਆਂ ਗਲਤੀਆਂ ਕਰਦੇ ਹਨ ਓਹਨਾਂ ਨੂੰ ਅਜਿਹੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ